ਮੈਨੂੰ ਬਚਪਨ ਤੋਂ ਹੀ ਸਿਲਾਈ ਬੁਣਾਈ ਕਢਾਈ ਦੇਖਣ ਦਾ ਅਤੇ ਸਿੱਖਣ ਦਾ ਬਹੁਤ ਸ਼ੌਕ ਸੀ ਮੇਰੇ ਮਾਤਾ ਜੀ ਘਰ ਵਿੱਚ ਆਪ ਹੀ ਸਿਲਾਈ ਕਢਾਈ ਅਤੇ ਬੁਣਾਈ ਦਾ ਕੰਮ ਕਰਦੇ ਸੀ ਮੈਂ ਛੋਟੀ ਉਮਰ ਤੋਂ ਹੀ ਇਹ ਕੰਮ ਉਹਨਾਂ ਵੱਲ ਇੱਕ ਦੇਖ ਦੇਖ ਕੇ ਆਪਣੇ ਅੰਦਰ ਸ਼ੌਕ ਪੈਦਾ ਕੀਤਾ ਅਤੇ ਪੰਦਰਾਂ ਸਾਲ ਦੀ ਉਮਰ ਵਿੱਚ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਕੋਲੋਂ ਕਢਾਈ ਕੱਢਣੀ ਸਿੱਖੀ ਉਹਨਾਂ ਨੇ ਮੈਨੂੰ ਸਿਲਾਈਆਂ ਦੇ ਨਾਲ ਕਢਾਈ ਕੱਢਣੀ ਦੱਸੀ ਅਤੇ ਉਹਨਾਂ ਨੇ ਮੈਨੂੰ ਸਿਖਾਇਆ ਕਿ ਕਿੰਝ ਵੱਖ ਵੱਖ ਪੈਟਰਨ ਬਣਾ ਬਣਾ ਕੇ ਆਪਾਂ ਡਿਜ਼ਾਈਨਦਾਰ ਕੋਟੀਆਂ ਬਣਾ ਸਕਦੇ ਹਾਂ ਇਹ ਸਾਰੀ ਕਲਾ ਆਪਣੇ ਮਾਤਾ ਜੀ ਕੋਲੋਂ ਸਿੱਖ ਕੇ ਫਿਰ ਮੈਂ ਜਿਗ ਜੈਗ ਪੈਟਰਨ ਦੀ ਇੱਕ ਕੋਟੀ ਤਿਆਰ ਕੀਤੀ ਉਹ ਆਪਣੇ ਮਾਤਾ ਜੀ ਦੀ ਮੈਂ ਬਣਾਈ ਮੇਰੇ ਮਾਤਾ ਜੀ ਉਹ ਪਾ ਕੇ ਬਹੁਤ ਖੁਸ਼ ਹੋਏ ਅਤੇ ਫਿਰ ਉਸ ਤੋਂ ਬਾਅਦ ਮੈਨੂੰ ਹੋਰ ਸ਼ੌਕ ਪੈਦਾ ਹੋਇਆ ਅਤੇ ਮੈਂ ਉਹਨਾਂ ਦੇ ਕੋਲੋਂ ਸੂਟ ਸਿਊਣ ਦੀ ਵੀ ਜਾਂਚ ਸਿੱਖੀ ਉਹਨਾਂ ਨੇ ਮੈਨੂੰ ਕੱਟ ਕੇ ਸਿਲਾਈਆਂ ਅਤੇ ਨਵੇਂ ਨਵੇਂ ਤਰੀਕੇ ਦੇ ਸੂਟ ਬਣਾਉਣੇ ਸਿਖਾਏ ਅਤੇ ਫਿਰ ਮੈਂ ਉਹਨਾਂ ਦੇ ਲਈ ਨਵੇਂ ਨਵੇਂ ਤਰੀਕੇ ਦੇ ਡਿਜਾਇਨ ਪਾ ਪਾ ਕੇ ਸੂਟ ਸਿਊਣੇ ਸਿੱਖ ਲਏ ਜਦੋਂ ਮੈਂ ਇਹ ਸਭ ਕੁਝ ਸਿੱਖ ਲਿਆ ਤਾਂ ਫਿਰ ਮੈਂ ਇੱਕ ਸਿਲਾਈ ਮਸ਼ੀਨ ਖਰੀਦੀ ਜਿਸ ਦੇ ਨਾਲ ਮੈਂ ਹੋਰ ਵੀ ਵਧੀਆ ਤਰੀਕੇ ਨਾਲ ਡਿਜਾਈਨ ਪਾ ਕੇ ਉਹਨਾਂ ਦੇ ਸੂਟ ਬਣਾਉਣ ਲੱਗ ਪਈ ਅਤੇ ਆਪਣੇ ਇੰਨੇ ਸਾਲਾਂ ਦੇ ਤਜੁਰਬੇ ਦੇ ਵਿੱਚ ਫਿਰ ਹੌਲੀ ਹੌਲੀ ਫੁਲਕਾਰੀ ਕੱਢਣੀ ਸਿੱਖੀ ਅਤੇ ਮੈਂ ਬਹੁਤ ਵਧੀਆ ਤਰੀਕੇ ਦੇ ਫੁਲਕਾਰੀ ਦੇ ਦੁਪੱਟੇ ਵੀ ਬਣਾਏ